ਜਿਹੜੀਆਂ ਪੰਜਾਬ ਦੇ ਵਿੱਚ ਕੀ ਹੈ ਪ੍ਰਮੁੱਖ ਬੈਂਕ ਜਾਂ ਅ ਵਿੱਤੀ ਸੰਸਥਾਵਾਂ ਨੇ ਜਿਵੇਂ ਐੱਚ ਡੀ ਐੱਫ ਸੀ ਬੈਂਕ ਹੋ ਗਿਆ ਕੈਨਰਾ ਬੈਂਕ ਹੋ ਗਿਆ ਐੱਸ ਬੀ ਆਈ ਬੈਂਕ ਹੋ ਗਿਆ ਅ ਅਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹਨਾਂ ਦੇ ਵਿੱਚੋਂ ਮਤਲਬ ਮੇਰਾ ਜਿਹੜਾ ਵ ਵਾਹ ਏ ਉਹ ਕੀ ਹੈ ਐੱਚ ਡੀ ਐੱਫ ਸੀ ਬੈਂਕ ਨਾਲ਼ ਪਿਆ ਅਤੇ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਿਆ ਕਿ ਉਹ ਉਹਨਾਂ ਦੀ ਜਿਹੜੀ ਮਤਲਬ ਕਿ ਮ ਉਹ ਹੈ ਪ੍ਰੋਸੈਸ ਹੈ ਉਹਨਾਂ ਦਾ ਬਹੁਤ ਫਾਸਟ ਕੰਮ ਕਰਦੇ ਨੇ ਅਤੇ ਹਰੇਕ ਮਤਲਬ ਵਰਕਰ ਹੈ ਜਿਹੜਾ ਉਹਨਾਂ ਦਾ ਮ ਇਮਪਲੋਏ ਹੈ ਉਹ ਮਤਲਬ ਵਧੀਆ ਢੰਗ ਨਾਲ ਹਰੇਕ ਉਹ ਮਤਲਬ ਉਹਨੂੰ ਡੀਲ ਕਰਦਾ ਹੈ ਅਤੇ ਜਦੋਂ ਵੀ ਮਤਲਬ ਉਹਨਾਂ ਦੇ ਉਹ ਉੱਥੇ ਜਾਈ ਦਾ ਉੱਥੇ ਮਤਲਬ ਕੋਈ ਵੀ ਕੰਮ ਕਰਾਈ ਦਾ ਤਾਂ ਹਰੇਕ ਮਤਲਬ ਉਹਨਾਂ ਦਾ ਪ੍ਰੋਸੈਸ ਇੰਨਾਂ ਫਾਸਟ ਹੈ ਕਿ ਆਪਣਾ ਕੰਮ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਹੀ ਹੋ ਜਾਂਦਾ ਅਤੇ ਵਧੀਆ ਢੰਗ ਨਾਲ ਹੋ ਜਾਂਦਾ